ਮੈਂ ਸਭ ਤੋਂ ਪਹਿਲਾਂ ਤਸਵੀਰ ਪਾਰਕ ਵਿੱਚ ਘੁੰਮਣ ਗਿਆ ਸੀਗਾ ਉੱਥੇ ਕੁਛ ਫੁੱਲਾਂ ਫੁੱਲ ਦੇਖੇ ਅਤੇ ਫੁੱਲ ਮੈਨੂੰ ਕਾਫ਼ੀ ਸੁੰਦਰ ਲੱਗੇ ਅਤੇ ਪਹਿਲੀ ਵਾਰੀ ਮੈਂ ਤਸਵੀਰ ਉਹਨਾਂ ਗੁਲਾਬ ਦੇ ਫੁੱਲਾਂ ਦੀ ਖਿੱਚੀ ਸੀ ਜੋ ਕਿ ਮੇਰੇ ਕੋਲ ਅੱਜ ਤੱਕ ਸੇਵ ਹੈ ਉਹ ਤਸਵੀਰ ਕਾਫ਼ੀ ਸੁੰਦਰ ਸੀਗੀ ਉੱਥੇ ਮੈਂ ਕਈ ਤਸਵੀਰਾਂ ਖਿੱਚੀਆਂ ਉਸ ਟਾਈਮ ਮੇਰੀ ਉਮਰ ਲਗਭਗ ਚੌਦਾਂ ਸਾਲ ਦੀ ਸੀ ਅਤੇ ਮੈਂ ਇਹ ਤਸਵੀਰਾਂ ਖਿੱਚ ਕੇ ਆਪਣੇ ਨਾਲ ਲੈ ਕੇ ਆਇਆ ਅਤੇ ਅਜੇ ਤੱਕ ਮੇਰੇ ਕੋਲ ਸੇਵ ਨੇ ਉਹ ਤਸਵੀਰਾਂ ਮੇਰੇ ਲਈ ਇੱਕ ਯਾਦਗਾਰ ਪਲ ਹੈ